ਤੁਹਾਡੇ ਪ੍ਰਸ਼ਨ ਮੁਤਾਬਿਕ ਮੈਂ ਸਭ ਤੋਂ ਪਹਿਲਾਂ ਆਪਣਾ ਜ਼ਿਲ੍ਹਾ ਬਠਿੰਡਾ ਦਾ ਨਾਂ ਲੈਣਾ ਚਾਹੁੰਦਾ ਹਾਂ ਦੂਸਰਾ ਜ਼ਿਲ੍ਹਾ ਮੋਗਾ ਅਤੇ ਤੀਸਰਾ ਜ਼ਿਲ੍ਹਾ ਫਰੀਦਕੋਟ ਚੌਥਾ ਜ਼ਿਲ੍ਹਾ ਮੁਕਤਸਰ ਅਤੇ ਪੰਜਵਾਂ ਜ਼ਿਲ੍ਹਾ ਫਿਰੋਜ਼ਪੁਰ ਦਾ ਨਾਂ ਲੈਣਾ ਚਾਹੁੰਦਾ ਹਾਂ